ਹੈਲੋ ਮੈਂ ਅੰਜਲੀ ਮੈਂ ਪਿਜ਼ਾ ਔਡਰ ਕਰਨਾ ਸੀ ਮੈਨੂੰ ਪਿਜ਼ਾ ਦੇ ਕੇ ਜਾਇਓ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਹੁਣ ਗਿਆਰਾਂ ਵੱਜੇ ਹੋਏ ਹੈ ਮੈਨੂੰ ਬਾਰਾਂ ਵਜੇ ਤੱਕਣ ਮੇਰਾ ਪਿਜ਼ਾ ਪਹੁੰਚਾ ਦਿਓ ਮੈਨੂੰ ਬਹੁਤ ਹੀ ਭੁੱਖ ਲੱਗੀ ਹੋਈ ਹੈ ਮੈਨੂੰ ਤੁਹਾਡੇ ਪਿਜ਼ਾ ਵਾਲੇ ਦੇ ਬਹੁਤ ਹੀ ਪਿਜ਼ਾ ਵਧੀਆ ਲੱਗਦਾ ਹੈ ਤੁਸੀਂ ਮੈਨੂੰ ਪਿਜ਼ਾ ਦੇ ਕੇ ਜਾਇਓ ਹਰ ਵਾਰੀ ਮੈਂ ਤੁਹਾਡੇ ਤੋਂ ਹੀ ਪਿਜ਼ਾ ਮੰਗਾਉਂਦੀ ਹਾਂ ਕਿਉਂਕਿ ਮੈਨੂੰ ਤੁਹਾਡੇ ਰੈਸਟੋਰੈਂਟ ਦਾ ਪੀਜ਼ਾ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਆਪਣੇ ਬਡੇ ਦੀ ਪਾਰਟੀ ਲਈ ਵੀ ਤੁਹਾਡੇ ਤੋਂ ਹੀ ਔਡਰ ਕਰਦੀ ਹਾਂ ਤੁਸੀਂ ਮੈਨੂੰ ਪੈਸੇ ਦੀ ਥੋੜ੍ਹੀ ਜਿਹੀ ਛੋਟ ਦੇ ਦਿਓ ਕਿਉਂਕਿ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਹੁੰਦੇ ਧੰਨਵਾਦ